ਇਹ ਗੱਲ ਤਾਂ ਬਿਲਕੁਲ ਠੀਕ ਹੈ ਕਿ ਭਾਰਤ ਵਿੱਚ ਚਾਹ ਸਭ ਨੂੰ ਪਸੰਦ ਹੈ ਚਾਹ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ ਸਵੇਰੇ ਉੱਠਦਿਆਂ ਸਾਰ ਹੀ ਸਾਨੂੰ ਲੱਗਦਾ ਹੈ ਕਿ ਇੱਕ ਚਾਹ ਦਾ ਕੱਪ ਮਿਲ ਜਾਵੇ ਤਾਂ ਅਸੀਂ ਤਰੋਤਾਜ਼ਾ ਹੋ ਜਾਈਏ ਹੋਰ ਹੁੰਦਾ ਵੀ ਹੈ ਜਦੋਂ ਅਸੀਂ ਚਾਹ ਪੀ ਲੈਂਦੇ ਹਾਂ ਤਾਂ ਸਾਨੂੰ ਬੜਾ ਤਰੋਤਾਜ਼ਾ ਮਹਿਸੂਸ ਹੁੰਦਾ ਹੈ ਔਰ ਅਸੀਂ ਆਪਣੇ ਕੰਮਾਂ ਵਿੱਚ ਜੁੱਟ ਜਾਂਦੇ ਹਾਂ ਚਾਹ ਕਈ ਤਰ੍ਹਾਂ ਦੀ ਵੀ ਹੈ ਔਰ ਇਸਨੂੰ ਕਈ ਤਰੀਕਿਆਂ ਨਾਲ ਬਣਾਇਆ ਵੀ ਜਾਂਦਾ ਹੈ ਚਾਹ ਇੱਕ ਲੈਮਨ ਟੀ ਹੈ ਜਿਸ ਵਿੱਚ ਅਸੀਂ ਚਾਹ ਪੱਤੀ ਨੂੰ ਉਬਾਲ ਕੇ ਪਾਣੀ ਦੇ ਵਿੱਚ ਫਿਰ ਇਹਦੇ ਵਿੱਚ ਨਿੰਬੂ ਪਾ ਕੇ ਇਹਦਾ ਕਾਹਵਾ ਬਣਾ ਕੇ ਅਸੀਂ ਪੀ ਸਕਦੇ ਹਾਂ ਇਹ ਵੀ ਬਹੁਤ ਫਾਈਦੇਮੰਦ ਹੁੰਦੀ ਹੈ ਇੱਕ ਹੁੰਦੀ ਹੈ ਗ੍ਰੀਨ ਟੀ ਗ੍ਰੀਨ ਟੀ ਤਾਂ ਅੱਜ ਕੱਲ੍ਹ ਬਹੁਤ ਹੀ ਫੇਮਸ ਹੋ ਚੁੱਕੀ ਹੈ ਪ੍ਰਸਿੱਧ ਹੋ ਚੁੱਕੀ ਹੈ ਸਾਰਿਆਂ ਦੇ ਵਿੱਚ ਕਿਉਂਕਿ ਇਹਦੇ ਨਾਲ ਪਤਲੇ ਵੀ ਹੋਇਆ ਜਾਂਦਾ ਹੈ ਇਨਸਾਨ ਸਲਿਮ ਰਹਿੰਦਾ ਹੈ ਫਿਟ ਰਹਿੰਦਾ ਹੈ ਖਾਧਾ ਪੀਤਾ ਪਚ ਜਾਂਦਾ ਹੈ ਇੱਕ ਤੁਲਸੀ ਟੀ ਵੀ ਹੈ ਤੁਲਸੀ ਦੇ ਨਾਲ ਬਣਨ ਵਾਲੀ ਚਾਹ ਉਹਦੇ ਵਿੱਚ ਤੁਲਸੀ ਦੇ ਪੱਤੇ ਪਾ ਕੇ ਅਸੀਂ ਪਾਣੀ ਵਿੱਚ ਉਬਾਲ ਕੇ ਅਸੀਂ ਅਗਰ ਚਾਹ ਬਣਾਈਏ ਤਾਂ ਉਹਦੇ ਨਾਲ ਕਹਿੰਦੇ ਕਿ ਬੁਖਾਰ ਜੇ ਹੋਏ ਅੰਦਰ ਸਾਡੇ ਸਰੀਰ ਦੇ ਅੰਦਰ ਤਾਂ ਉਹ ਵੀ ਠੀਕ ਹੋ ਜਾਂਦਾ ਹੈ ਇੱਕ ਹੁੰਦੀ ਮਸਾਲਾ ਚਾਹ ਮਸਾਲਾ ਚਾਹ ਤਾਂ ਬਹੁਤ ਸਵਾਦ ਹੁੰਦੀ ਹੈ ਇਹ ਹਰ ਕਿਸੇ ਦੀ ਪਸੰਦ ਹੈ ਮਸਾਲਾ ਚਾਹ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਬਣਾ ਸਕਦੇ ਹਾਂ ਮਸਾਲਾ ਚਾਹ ਨੂੰ ਇਹਦੇ 'ਚ ਕਈ ਤਰ੍ਹਾਂ ਦੇ ਮਸਾਲੇ ਪੈਂਦੇ ਹਨ ਸਭ ਤੋਂ ਪਹਿਲਾਂ ਤਾਂ ਅਸੀਂ ਪਾਣੀ ਉਬਲਣਾ ਧਰਦੇ ਹਾਂ ਪਾਣੀ ਉਬਲਣ ਦੇ ਨਾਲ ਨਾਲ ਅਸੀਂ ਇਹਦੇ ਵਿੱਚ ਲੋਂਗ ਇਲਾਇਚੀ ਥੋੜ੍ਹੀ ਅਜਵਾਇਣ ਥੋੜ੍ਹਾ ਜਿਹਾ ਅਸੀਂ ਵਿੱਚ ਮਸਾਲਾ ਚਾਹ ਦਾ ਜਿਹਦੇ ਵਿੱਚ ਅਸੀਂ ਥੋੜ੍ਹੀ ਦਾਲ ਚੀਨੀ ਵੀ ਪਾ ਸਕਦੇ ਹਾਂ ਅਦਰਕ ਪਾ ਸਕਦੇ ਹਾਂ ਜਦੋਂ ਇਹ ਸਾਰੀਆਂ ਚੀਜ਼ਾਂ ਪਾ ਕੇ ਅਸੀਂ ਇਹਨੂੰ ਰਿੰਨ੍ਹਦੇ ਹਾਂ ਚੰਗੀ ਤਰ੍ਹਾਂ ਫਿਰ ਉਸ ਦੇ ਨਾਲ ਇਸਦੇ ਵਿੱਚ ਖੰਡ ਚਾਹੇ ਪੱਤੀ ਪਾ ਕੇ ਉਬਾਲਦੇ ਹਾਂ ਅਤੇ ਇਹਦੇ ਵਿੱਚੋਂ ਬਹੁਤ ਅੱਛੀ ਖੁਸ਼ਬੂ ਆਉਂਦੀ ਹੈ ਫਿਰ ਉਹਦੇ ਵਿੱਚ ਦੁੱਧ ਪਾ ਕੇ ਉਹਨੂੰ ਚੰਗੀ ਤਰ੍ਹਾਂ ਰਿੰਨ੍ਹਿਆ ਜਾਂਦਾ ਹੈ ਔਰ ਇਸ ਤਰੀਕੇ ਨਾਲ ਜਿਹੜੀ ਚਾਹ ਬਣਦੀ ਹੈ ਉਹਦਾ ਤਾਂ ਸਵਾਦ ਕਿਸੇ ਦਾ ਮੁਕਾਬਲਾ ਨਹੀਂ ਕਰ ਸਕਦਾ ਇਹੋ ਜਿਹੀ ਚਾਹ ਪੀ ਕੇ ਅਸੀਂ ਬਹੁਤ ਤਰੋਤਾਜ਼ਾ ਮਹਿਸੂਸ ਕਰਦੇ ਹਾਂ ਔਰ ਸਾਡੇ ਜਿਹੜੀ ਦਿਨ ਭਰ ਦੀ ਥਕਾਨ ਹੈ ਉਹ ਵੀ ਦੂਰ ਹੋ ਜਾਂਦੀ ਆ